ਟਰੈਕਿੰਗ ਜਾਂ ਟਰੈਕਿੰਗ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਥਾਂ ਦੀ ਜਾਣਕਾਰੀ ਇਥੇ ਸਾਡੇ ਟਰੈਕਿੰਗ ਦੀ ਕਿੰਨੀ ਕੁ ਮਹੱਤਤਾ ਹੈ ਇਹ ਸਾਡੇ 'ਤੇ ਕਿਵੇਂ ਫਾਇਦੇਮੰਦ ਹੁੰਦਾ ਹੈ ਟਰੈਕਿੰਗ ਦਾ ਟਰੈਕਿੰਗ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਥਾਂ ਦੀ ਜਾਣਕਾਰੀ ਬਹੁਤ ਮਹੱਤਵ ਹੈ ਇਹ ਜਾਣਕਾਰੀ ਸੁਰੱਖਿਆ ਲਈ ਜ਼ਰੂਰੀ ਹੈ ਜਿਸ ਲਈ ਅਸੀਂ ਖਤਰਨਾਮਾ ਰਸਤਿਆਂ ਤੋਂ ਮੌਸਮ ਤੋਂ ਬਚ ਸਕੇ ਅਤੇ ਯੋਜਨਾਬੰਦ ਲਈ ਇਹ ਵੀ ਜ਼ਰੂਰੀ ਹੈ ਕਿਉਂਕਿ ਇਸ ਲਈ ਅਸੀਂ ਆਮ ਯਾਤਰਾ ਦਾ ਸਮਾਂ ਰਸਤੇ ਅਤੇ ਆਉਣ ਜਾਣ ਸਮਾਂ ਤੈਅ ਕਰ ਸਕਦੇ ਹਾਂ ਸਾਥੀ ਗੁਜਾਨ ਜਾਣਕਾਰੀ ਸਾਨੂੰ ਸਾਨੂੰ ਉਹਨਾਂ ਉਸ ਥਾਂ ਤੋਂ ਸੱਭਿਆਚਾਰ ਅਤੇ ਸਾਹਿਤ ਅਤੇ ਕੁਦਰਤ ਦੇ ਸੁੰਦਰਤਾ ਦੇ ਬਾਰੇ ਦੱਸਦੇ ਹੈ ਜੋ ਸਾਡੇ ਸੰਭਵਦਾ ਹੈ ਹੋਰ ਵੀ ਆਰਾਮ ਬਣਦਾ ਹੈ ਇਸ ਲਈ ਜਾਣਕਾਰੀ ਠੀਕ ਕਰਨ ਲਈ ਸਾਡੀ ਯਾਤਰਾ ਨੂੰ ਸੁਰੱਖਿਅਤ ਅਤੇ ਯਾਦਗਾਰੀ ਬਣਾ ਸਕਦੇ ਹੋ ਧੰਨਵਾਦ